ਹੈਲੋ ਹਾਂਜੀ ਹਾਂਜੀ ਹਾਂਜੀ ਆਈਲੈਟਸ ਦੇ ਵਿੱਚ ਆਪਾਂ ਮਤਲਬ ਆਈਲਸ ਪੀ ਟੀ ਕਰਵਾਉਂਦੇ ਹਾਂ ਆਏ ਅਤੇ ਇੰਗਲਿਸ਼ ਸਪੀਕਿੰਗ ਕਰਵਾਉਂਦੇ ਹਾਂ ਹਾਂਜੀ ਇਹਦਾ ਦੇਖੋ ਵੀਰੇ ਤੁਹਾਡੇ 'ਤੇ ਡਿਪੈਂਡ ਆ ਹੈਨਾ ਮੇਰੇ ਕੋਲ ਮਤਲਬ ਕਈ ਸਟੂਡੈਂਟ ਹੈਗੇ ਆ ਜਿਹਨਾਂ ਨੇ ਟੂ ਮੰਥ ਦੇ ਅੰਦਰ ਅੰਦਰ ਹੀ ਸੱਤ ਬੈਡ ਲਏ ਆ ਹੈਨਾ ਅਤੇ ਉਹ ਬਾਕੀ ਤੁਹਾਡੇ 'ਤੇ ਮਿਹਨਤ 'ਤੇ ਡਿਪੈਂਡ ਆ ਵੀ ਤੁਸੀਂ ਟੂ ਮੰਥ ਦੇ ਅੰਦਰ ਵੀ ਲੈ ਕੇ ਆ ਸਕਦੇ ਹੋ ਅਤੇ ਥਰੀ ਮੰਥ ਬਾਕੀ ਥਰੀ ਮੰਥ ਦੇ ਅੰਦਰ ਵੀ ਲੈ ਕੇ ਆ ਸਕਦੇ ਹੋ ਹਾਂਜੀ ਆਪਣੀ ਫ਼ੀਸ ਹੈਗੀ ਆ ਮੰਥਲੀ ਸੱਤ ਹਜ਼ਾਰ ਰੁਪਏ ਹਾਂਜੀ ਟੋਟਲ ਆਪਣੇ ਤਿੰਨ ਮਹੀਨਿਆਂ ਦਾ ਇਹ ਤਾਂ ਮਤਲਬ ਤੁਸੀਂ ਮੰਥਲੀ ਦੇਣੀ ਹੈ ਤਾਂ ਮਤਲਬ ਸੱਤ ਹਜ਼ਾਰ ਠੀਕ ਹੈ ਜੀ ਤੁਸੀਂ ਪੂਰੇ ਮਤਲਬ ਥਰੀ ਮੰਥ ਦੀ ਇਕੱਠੀ ਦਿਓਗੇ ਮਤਲਬ ਥਰੀ ਮੰਥ ਬਾਅਦ ਦਿਓਗੇ ਤਾਂ ਤੁਹਾਨੂੰ ਡਿਸਕਾਉਂਟ ਮਿਲਜੁਗਾ ਹਜ਼ਾਰ ਰੁਪਏ ਦਾ ਹਾਂਜੀ ਹੋਰ ਤਾਂ ਤੁਸੀਂ ਆਪ ਦੇਖੋ ਕਿ ਤੁਸੀਂ ਕਦੋਂ ਤੋਂ ਸਟਾਰਟ ਕਰਨਾ ਹੈ ਨਾ ਕਦੋਂ ਕੀ ਕਰਨਾ ਕੀ ਨਹੀਂ ਤੁਸੀਂ ਦੱਸੋ ਤੁਹਾਡੇ 'ਤੇ ਡਿਪੈਂਡ ਆ ਹਾਂਜੀ ਡੈਮੋ ਕਲਾਸਾਂ ਕਰ ਸਕਦੇ ਹੋ ਤੁਸੀਂ ਕੁਛ ਦਿਨਾਂ ਲਈ ਜਦੋਂ ਮਰਜ਼ੀ ਹਾਂਜੀ ਹਾਂਜੀ ਹਾਂਜੀ ਡੈਮੋ ਰੱਖੋ ਤੁਸੀਂ ਤੁਹਾਨੂੰ ਪਤਾ ਲੱਗ ਜੂਗਾ ਤੁਸੀਂ ਤਿੰਨ ਦਿਨ ਆਪਣੀ ਮਤਲਬ ਸੈਂਟਰ ਦੇ ਵਿੱਚ ਤਿੰਨ ਦਿਨ ਫਰੀ ਕਲਾਸਾਂ ਲਵਾਉਂਦੇ ਹਾਂ ਡੈਮੋ ਦੀਆਂ ਤੁਸੀਂ ਕਰ ਸਕਦੇ ਹੋ ਆਪਣੇ ਸੈਂਟਰ ਦੀ ਟਾਈਮਿੰਗ ਹੈ ਨੌ ਤੋਂ ਪੰਜ ਹਾਂਜੀ ਹਾਂਜੀ ਜ਼ਰੂਰ ਆਪਣੀ ਫੈਮਲੀ ਨਾਲ ਡਿਸਕਸ ਕਰਕੇ ਦੱਸਿਓ ਮੈਨੂੰ ਜ਼ਰੂਰ ਕੋਈ ਚੱਕਰ ਨਹੀਂ ਤੁਸੀਂ ਦੱਸ ਦਿਓ ਬਾਕੀ ਸੱਚ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਇੱਕ ਗੱਲ ਕਹਿਣੀ ਭੁੱਲ ਗਈ ਮਤਲਬ ਜੇ ਤੁਸੀਂ ਟੂ ਮੰਥ ਦੇ ਅੰਦਰ ਵੀ ਤੁਸੀਂ ਅਵਰ ਸਬਜੈਕਟ ਦੇ ਵਿੱਚ ਤੁਸੀਂ ਸਾਢੇ ਛੇ ਬੈਂਡ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਵੀ ਤੁਹਾਨੂੰ ਡਿਸਕਾਊਂਟ ਮਿਲੂਗਾ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਪੁ ਮਤਲਬ ਆਲ ਸਬਜੈਕਟ ਦੇ ਅੰਦਰ ਤੁਸੀਂ ਸਾਢੇ ਛੇ ਬੈਂਡ ਲੈ ਕੇ ਆਓਗੇ ਨਾ ਤਾਂ ਤੁਹਾਨੂੰ ਡਿਸਕਾਊਂਟ ਮਿਲੂਗਾ ਹਾਂਜੀ ਹਾਂਜੀ ਹਾਂਜੀ ਜ਼ਰੂਰ ਆਪਣੀ ਫੈਮਲੀ ਨਾਲ ਡਿਸਕਸ ਕਰੋ ਫਿਰ ਤੁਸੀਂ ਆਓ ਡੈਮੋ ਕਲਾਸਿਸ ਲਈ ਤਾਂ ਤੁਸੀਂ ਕਦੋਂ ਮਤਲਬ ਅੱਜ ਤੋਂ ਵੀ ਆ ਜਾਓ ਕੱਲ੍ਹ ਤੋਂ ਵੀ ਆ ਜਾਓ ਜਦੋਂ ਮਰਜ਼ੀ ਆ ਜਾਓ ਡੈਮੋ ਕਲਾਸਾਂ ਕਦੋਂ ਮਰਜ਼ੀ ਰੱਖ ਸਕਦੇ ਹੋ ਹਾਂਜੀ ਟਾਈਮਿੰਗ ਨੌ ਤੋਂ ਪੰਜ ਹੀ ਹੈ ਹਾਂਜੀ ਠੀਕ ਹੈ ਜੀ